ਗੂਗਲ ਵੈਦਰ ਰਾਹੀਂ ਅਸੀਂ ਮੌਸਮ ਬਾਰੇ ਜਾਣ ਸਕਦੇ ਹਾਂ ਮਾਈਮੰਡੀ ਐਪ ਰਾਹੀਂ ਅਸੀਂ ਮੰਡੀਆਂ ਦੇ ਭਾਅ ਜਾਣ ਸਕਦੇ ਹਾਂ ਖੇਤੀਬਾੜੀ ਮੇਡ ਈਜੀ ਰਾਹੀਂ ਅਸੀਂ ਨਵੀਆਂ ਨਵੀਆਂ ਫਸਲਾਂ ਨੂੰ ਕਿਸ ਤਰ੍ਹਾਂ ਉਗਾਉਣਾ ਹੈ ਅਤੇ ਉਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਰਾਹੀਂ ਬਾਰੇ ਜਾਣ ਸਕਦੇ ਹਾਂ